ਪੰਦਰ੍ਹਾਂ ਅਗਸਤ ਉੱਨੀ ਸੌ ਸਨਤਾਲੀ ਤੀਹ ਜਨਵਰੀ ਦੋ ਹਜ਼ਾਰ ਤੇਈ ਚਾਰ ਮਾਰਚ ਦੋ ਹਜ਼ਾਰ ਤੇਈ ਚੌਦ੍ਹਾਂ ਦਸੰਬਰ ਦੋ ਹਜ਼ਾਰ ਇੱਕੀ ਬਾਈ ਜੁਲਾਈ ਦੋ ਹਜ਼ਾਰ ਤੇਈ